ਮੇਰਾ ਨਾਮ ਬਲਜੀਤ ਸਿੰਘ ਹੈ ਮੇਰੀ ਉਮਰ ਤੀਹ ਸਾਲ ਦੀ ਹੈ ਮੇਰਾ ਪਿੰਡ ਪਡਿਆਲ਼ਾ ਹੈ ਜੋ ਕਿ ਜ਼ਿਲ੍ਹਾ ਮੋਹਾਲੀ ਵਿੱਚ ਪੈਂਦਾ ਹੈ ਮੈਂ ਬਾਰ੍ਹਵੀਂ ਤੱਕ ਪੜ੍ਹਿਆ ਹੋਇਆ ਹਾਂ ਮੈਂ ਪੈਟਰੋਲ ਪੰਪ 'ਤੇ ਕੰਮ ਕਰਦਾ ਹਾਂ ਮੈਨੂੰ ਫੁੱਟਬਾਲ ਖੇਡਣ ਦਾ ਸ਼ੌਕ ਹੈ